ਅਸੀਂ ਇਸ ਵਾਰ ਕੋਲਜ ਦੀਆਂ ਛੁੱਟੀਆਂ ਵਿੱਚ ਸ਼੍ਰੀਨਗਰ ਘੁੰਮਣ ਲਈ ਗਏ ਸਭ ਤੋਂ ਪਹਿਲਾਂ ਅਸੀਂ ਡੱਲ ਲੇਕ 'ਤੇ ਗਏ ਘੁੰਮਣ ਤੋਂ ਬਾਅਦ ਅਸੀਂ ਦੇਖਿਆ ਨਾਲ ਹੀ ਸ਼ਾਲੀਮਾਰ ਗਾਰਡਨ ਸੀ ਜਦੋਂ ਅਸੀਂ ਉੱਥੇ ਗਏ ਉਸ ਦਾ ਇਤਿਹਾਸ ਪੜ੍ਹਿਆ ਤਾਂ ਦੇਖਿਆ ਇਹ ਡੱਲ ਲੇਕ ਦੇ ਉੱਤਰ ਪੂਰਬ ਵਿੱਚ ਅ ਸ ਸਥਿਤ ਹੈ ਅਤੇ ਇਸ ਨੂੰ ਮੁਗਲ ਬਾਦਸ਼ਾਹ ਜਹਾਂਗੀਰ ਨੇ ਬਣਵਾਇਆ ਹੋਇਆ ਹੈ ਅਤੇ ਉਸ ਤੋਂ ਬਾਅਦ ਅਸੀਂ ਜਦੋਂ ਅੰਦਰ ਗਏ ਤਾਂ ਅੰਦਰ ਦੇਖਦੇ ਹਾਂ ਕਿ ਉੱਥੇ ਬਹੁਤ ਜ਼ਿਆਦਾ ਸੁੰਦਰ ਕਈ ਕਿਸਮਾਂ ਦੇ ਫੁੱਲ ਸਾਨੂੰ ਦੇਖਣ ਨੂੰ ਮਿਲੇ ਅਤੇ ਫੁੱਲ ਐਨੇ ਸੋਹਣੇ ਸੀ ਕਿ ਮਨ ਬਹੁਤ ਪ੍ਰਭਾਵਿਤ ਹੋਇਆ ਅਤੇ ਖੁਸ਼ ਹੋਇਆ ਅਤੇ ਸਾਨੂੰ ਬਹੁਤ ਵਧੀਆ ਲੱਗਿਆ ਅਤੇ ਦੁਨੀਆ ਦਾ ਸਭ ਤੋਂ ਵਧੀਆ ਗਾਰਡਨ ਹੈ